ਤੇਰਾਂ ਇੱਕ ਸੌ ਅੱਸੀ ਬਾਰਾਂ ਸੌ ਨੱਬੇ ਦੋ ਲੱਖ ਪੈਂਤੀ ਹਜ਼ਾਰ ਪੰਜ ਸੌ ਸੱਤਰ ਅੱਠ ਲੱਖ ਅੱਸੀ ਹਜ਼ਾਰ ਨੌ ਸੌ